ਫਤਿਹਗੜ੍ਹ ਜ਼ਿਲ੍ਹੇ ਵਿੱਚ ਬਜ਼ੁਰਗ ਵਰਗ ਨੂੰ ਕਾਫੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ ਸਿਹਤ ਪ੍ਰਤੀ ਚੁਨੌਤੀ ਇਸ ਉਮਰ ਵਿੱਚ ਬਜ਼ੁਰਗਾਂ ਨੂੰ ਸਿਹਤ ਪ੍ਰਤੀ ਬਹੁਤ ਸਾਰੀਆਂ ਚੁਨੌਤੀਆਂ ਆਉਂਦੀਆਂ ਹਨ ਜਿਵੇਂ ਕਿ ਹਾਰਟ ਅਟੈਕ ਸ਼ੂਗਰ ਬੀ ਪੀ ਦੀ ਸਮੱਸਿਆ ਉਸ ਤੋਂ ਬਿਨਾਂ ਅਗਰ ਆਪਾਂ ਗੱਲ ਕਰੀਏ ਤਾਂ ਸਮਾਜਿਕ ਚੁਨੌਤੀ ਵੀ ਪ੍ਰਮੁੱਖ ਹੈ

ਤਾਂ ਬਜ਼ੁਰਗਾਂ ਨੂੰ ਇਸ ਤਰ੍ਹਾਂ ਦਾ ਪਲੇਟਫੋਮ ਪ੍ਰੋਵਾਈਡ ਕਰਨਾ ਚਾਹੀਦਾ ਹੈ ਕਿ ਜਿੱਥੇ ਉਹ ਆਪਣੀ ਕਮਿਊਨਿਟੀ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰ ਸਕੀਏ ਅਤੇ ਉਹ ਆਪਣੇ ਆਪ ਨੂੰ ਇਕੱਲਾ ਫੀਲ ਨਾ ਕਰਨ